ਸਥਾਨਕ ਲੋਕਾਂ ਦੁਆਰਾ ਧਰਮ ਨੂੰ ਬਹੁਤ ਹੀ ਆਦਰ ਅਤੇ ਸਨਮਾਨ ਨਾਲ ਅਪਣਾਇਆ ਜਾਂਦਾ ਹੈ ਹਰ ਇੱਕ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਦਾ ਹੈ ਕੋਈ ਵੀ ਇੱਕ ਦੂਜੇ ਨਾਲ ਇਰਸ਼ਾ ਨਹੀਂ ਕਰਦਾ ਅਤੇ ਸਾ ਸਾਰੇ ਹੀ ਸੱਭਿਆਚਾਰਕ ਅਤੇ ਆਪਣੇ ਭਾਈਚਾਰੇ ਦਾ ਪ੍ਰਤੀਕ ਮੰਨਦੇ ਹਨ ਇੱਕ ਦੂਜੇ ਦੇ ਧਰਮ ਦੀ ਰੱਖਿਆ ਕਰਦੇ ਹਨ ਇੱਕ ਦੂਜੇ ਦੇ ਸੁੱਖ ਦੁੱਖ ਦੇ ਸਾਂਝੀ ਬਣਦੇ ਹਨ ਅਤੇ ਸਥਾਨਕ ਲੋਕ ਜਿਹੜੇ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਸੱਭਿਆਚਾਰ ਨੂੰ ਅਪਣਾਉਂਦੇ ਹਨ ਅਤੇ ਹਰ ਇੱਕ ਦੇ ਧਰਮ ਦੀ ਇੱਜ਼ਤ ਕਰਦੇ ਹਨ